ਬਚਪਨ ਤੋਂ ਹੀ ਮੈਨੂੰ ਗਾਉਣ ਦਾ ਸ਼ ਬਹੁਤ ਹੀ ਸ਼ੌਂਕ ਸੀ ਅਤੇ ਮੇਰਾ ਟੈਲਂਟ ਸਕੂਲ 'ਚ ਦੇਖਿਆ ਗਿਆ ਅਤੇ ਜਦ ਮੈਂ ਪਹਿਲੀ ਵਾਰ ਸੌਂਗ ਗਾਇਆ ਤਾਂ ਸਾਰਿਆ ਨੂੰ ਬਹੁਤ ਹੀ ਪਸੰਦ ਆਇਆ ਇਸ ਕਰਕੇ ਮੈਂ ਬਹੁਤ ਹੀ ਸੌਂਗ ਵਧੀਆ ਲੱਗਿਆ ਸਾਰਿਆ ਨੂੰ ਅਤੇ ਮੈਂ ਅੱਗੇ ਅੱਗੇ ਵੱਧਦਾ ਗਿਆ ਫਿਰ ਮੈਂ ਸਕੂਲ 'ਚ ਕੋਂਪੀਟੀਸ਼ਨ ਹੋਣ ਲੱਗ ਪਏ ਅਤੇ ਮੈਂ ਭਾਗ ਲੈਂਦਾ ਰਿਹਾ ਮੈਂ ਹਰੇਕ ਕੋਂਪੀਟੀਸ਼ਨ ਵਿੱਚ ਗਾਉਣੇ ਗਾਉਣ ਦਾ ਸੀਗਿੰਗ ਕਰਨ ਦਾ ਭਾਗ ਲਿਆ ਅਤੇ ਮੈਂ ਹਰੇਕ ਕੋਂਪੀਟੀਸ਼ਨ ਵਿੱਚ ਫਸਟ ਆਇਆ ਇਸ ਕਰਕੇ ਮੈਨੂੰ ਲੋਕੀਆਂ ਨੇ ਬਹੁਤ ਹੀ ਪਿਆਰ ਦਿੱਤਾ ਜਿਸ ਕਰਕੇ ਮੈਂ ਫਿਰ ਅੱਗੇ ਅੱਗੇ ਵੱਧਦਾ ਗਿਆ ਅਤੇ ਮਿਹਨਤ ਕਰਦਾ ਗਿਆ ਇਸ ਕਰਕੇ ਫਿਰ ਜੇ ਸਾਡੇ ਪਿੰਡਾਂ ਵਿੱਚ ਵੀ ਕੋਈ ਸੱਭਿਆਚਾਰ ਪ੍ਰੋਗਰਾਮ ਹੁੰਦਾ ਤਾਂ ਮੈਂ ਉਸ 'ਤੇ ਵੀ ਜਾਇਆ ਕਰਦਾ ਸੀ ਅਤੇ ਉੱਥੇ ਵੀ ਲੋਕਾਂ ਨੇ ਮੈਨੂੰ ਬਹੁਤ ਹੀ ਪਿਆਰ ਕਰਦੇ ਸੀ ਜੋ ਕਿ ਲੋਕ ਬਹੁਤ ਹੀ ਅਨੰਦ ਮਾਣਦੇ ਸੀ ਅਤੇ ਮੇਰੀ ਅਵਾਜ਼ ਵੀ ਬਹੁਤ ਮਿੱਠੀ ਸੀ ਜੋ ਕਿ ਲੋਕਾਂ ਨੂੰ ਬਹੁਤ ਹੀ ਪਿਆਰੀ ਲੱਗਦੀ ਸੀ ਅਤੇ ਲੋਕੀਂ ਮੈਨੂੰ ਬਹੁਤ ਹੀ ਜ਼ਿਆਦਾ ਪਿਆਰ ਦਿੰਦੇ ਸੀ ਅਤੇ ਮੈਂ ਇਸ ਕਰਕੇ ਅੱਗੇ ਅੱਗੇ ਵੱਧਦਾ ਗਿਆ ਅਤੇ ਫਿਰ ਮੈਂ ਸਾਰੇ ਪ੍ਰੋਗਰਾਮ ਲਾਏ ਹਨ ਅਤੇ ਇਸ ਕਰਕੇ ਮੈਂ ਬਹੁਤ ਹੀ ਮਿਹਨਤ ਕੀਤੀ ਮਿਹਨਤ ਕਰਕੇ ਮੈਂ ਪੈਸੇ ਇਕੱਠੇ ਕਰਕੇ ਫਿਰ ਮੈਂ ਆਪਣੀ ਇੱਕ ਐਲਬਮ ਵੀ ਤਿਆਰ ਕੀਤੀ ਜੋ ਕਿ ਲੋਕਾਂ ਨੂੰ ਬਹੁਤ ਹੀ ਪਸੰਦ ਆਈ ਅਤੇ ਲੋਕਾਂ ਨੇ ਬਹੁਤ ਜ਼ਿਆਾਦਾ ਹੀ ਵਧੀਆ ਲੱਗੀ ਲੋਕਾਂ ਨੇ ਬਹੁਤ ਹੀ ਮੇਰਾ ਦਿਲੋਂ ਧੰਨਵਾਦ ਕੀਤਾ ਅਤੇ ਮੈਂ ਉਹਨਾਂ ਲੋਕਾਂ ਦਾ ਬਹੁਤ ਹੀ ਧੰਨਵਾਦ ਕਰਦਾਂ ਏ ਜਿਨ੍ਹਾਂ ਨੇ ਮੈਨੂੰ ਇੰਨਾਂ ਪਿਆਰ ਦਿੱਤਾ ਇੰਨੀ ਮੇਰੀ ਮਿਹਨਤ ਦੇਖੀ ਅਤੇ ਮੈਨੂੰ ਹੀ ਬਹੁਤ ਹੀ ਪਿਆਰ ਦਿੱਤਾ ਇਸ ਕਰਕੇ ਮੈਨੂੰ ਸੀਗਿੰਗ ਨਾਲ਼ ਬਹੁਤ ਹੀ ਪਿਆਰ ਹੈ ਸੀਗਿੰਗ ਇੱਕ ਮੇਰਾ ਬਹੁਤ ਹੀ ਸੀਗਿੰਗ ਨਾਲ਼ ਪਿਆਰ ਹੈ